ਅਸੀਂ ਤਿੰਨ ਭਰਾ ਅਤੇ ਤਿੰਨ ਮ ਭੈਣਾਂ ਸੀ ਸਾਡੀਆਂ ਭੈਣਾਂ ਦੀ ਤਿੰਨਾਂ ਦੀ ਸ਼ਾਦੀ ਕਰਤੀ ਅਤੇ ਉਹ ਆਪਣੇ ਆਪਣੇ ਘਰਾਂ ਸ ਸੌਖੀ ਵੱਸਦੀਆਂ ਨੇ ਅਤੇ ਦੋ ਭਰਾ ਮੇਰੇ ਪਿੰਡ ਹੈ ਅਤੇ ਮੈਂ ਸਰਵਿਸ ਕਰਦਾ ਜੀ ਚੰਡੀਗੜ੍ਹ ਦੇ ਵਿੱਚ ਉਹ ਭਰਾ ਦੋਨੋਂ ਖੇਤੀ ਕਰਦੇ ਸੀ ਬੇਸ਼ੱਕ ਸਾਡੀ ਕੰਬਾਈਨ ਫੈਮਿਲੀ ਤੀ ਪਰ ਮੈਨੂੰ ਨੌਕਰੀ ਦੇ ਨਾਲ਼ ਚੰਡੀਗੜ੍ਹ ਰਹਿਣਾ ਪੈ ਗਿਆ ਅਤੇ ਇੱਕ ਵੱਖਰਾ ਰਹਿਣਾ ਪੈ ਗਿਆ ਪਰ ਤਾਲਮੇਲ ਸਾਡਾ ਉਦੋਂ ਵੀ ਸੀ ਜੋ ਹੁਣ ਬੇਸ਼ੱਕ ਹੁਣ ਭਰਾਵਾਂ ਦੀ ਡੈੱਥ ਹੋ ਗਈ ਹੈ ਪਰ ਉਹਨਾਂ ਦੇ ਭਤੀਜਿਆਂ ਨਾਲ਼ ਵੀ ਆਪਾਂ ਉਸ ਤਰ੍ਹਾਂ ਵਰਤਦੇ ਹਾਂ ਜਿਵੇਂ ਸਾਡੇ ਆਪਣੇ ਭਾਈ ਨਾਲ ਵਰਤੇ ਜੀ ਅਤੇ ਬਾਕੀ ਜੋ ਦੁਨੀਆਂਦਾਰੀ ਹੈ ਪਹਿਲਾਂ ਤੋਂ ਚੱਲਦੀ ਆ ਰਹੀ ਇੱਦਾਂ ਹੀ ਚੱਲੀ